ਅੱਠ ਨਵੰਬਰ ਉੱਨੀ ਸੌ ਪੰਜਾਹ ਬਾਈ ਸਤੰਬਰ ਉੱਨੀ ਸੌ ਪੰਝੱਤਰ ਦਸ ਮਾਰਚ ਉੱਨੀ ਸੌ ਇੱਕਵੰਜਾ ਅੱਠ ਨਵੰਬਰ ਉੱਨੀ ਸੌ ਅਠਾਸੀ ਪੰਦਰਾਂ ਅਗਸਤ ਉੱਨੀ ਸੌ ਸੰਤਾਲੀ